ਹਾਂ ਸਾਨੂੰ ਲੱਗਦਾ ਹੈ ਕਿ ਕਿਸੇ ਹੋਰ ਗ੍ਰਹਿ 'ਤੇ ਵੀ ਜਾ ਕੇ ਆਪਾਂ ਜੀਵਨ ਜਾਂ ਹੋਰ ਗ੍ਰਹਿ 'ਤੇ ਵੀ ਜੀਵਨ ਹੈ ਕਿਉਂਕਿ ਇਸ ਬਾਰੇ ਮੈਂ ਅਖਬਾਰ ਵਿੱਚ ਪੜ੍ਹਿਆ ਸੀਗਾ ਕਿ ਜਿਵੇਂ ਹੁਣ ਥੋੜ੍ਹੇ ਟਾਈਮ ਪਿੱਛੇ ਚੰਦਰਯਾਨ ਥ੍ਰੀ ਲੋਂਚ ਹੋਇਆ ਸੀਗਾ ਅਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਕਿ ਸਟੇਅ ਕੀਤਾ ਫਿਰ ਉਹ ਵਾਪਸ ਆਏ ਇਸ ਕਰਕੇ ਸਾਨੂੰ ਇੱਥੋਂ ਹੀ ਦੇਖਣ ਨੂੰ ਮਿਲਦਾ ਥੋੜ੍ਹਾ ਕਿ ਉਹ ਉੱਥੇ ਜਾ ਕੇ ਜਾਂ ਫਿਰ ਜਾਂ ਆਪਾਂ ਕਹਿ ਸਕਦੇ ਆ ਕਿ ਮੰਗਲ ਗ੍ਰਹਿ ਉੱਤੇ ਵੀ ਆਪਾਂ ਜੀਵਨ ਬਤੀਤ ਕਰ ਸਕਦੇ ਆ ਕਿਉਂਕਿ ਉੱਥੇ ਪਾਣੀ ਹੈ ਬਟ ਇੱਕ ਇਹ ਵੀ ਹੋਇਆ ਕਿ ਉੱਥੇ ਆਕਸੀਜਨ ਦੀ ਥੋੜ੍ਹੀ ਕਮੀ ਹੈ ਜਿਹਦੇ ਕਰਕੇ ਥੋੜ੍ਹਾ ਆਪਾਂ ਉੱਥੇ ਸਟੇਅ ਕਰਨਾ ਸਾਡੇ ਲਈ ਥੋੜ੍ਹਾ ਔਖਾ ਹੋ ਜਾਂਦਾ ਬਟ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੋਰ ਗ੍ਰਹਿਆਂ 'ਤੇ ਵੀ ਜੀਵਨ ਹੈ ਜਿਹਦੇ ਬਾਰੇ ਆਪਾਂ ਹਰ ਰੋਜ਼ ਨਿਊਜ਼ਪੇਪਰਾਂ ਵਿੱਚ ਜਾਂ ਕੋਈ ਇੰਟਰਨੈਟ ਉੱਤੇ ਸਾਨੂੰ ਰੋਜ਼ ਕੋਈ ਨਾ ਕੋਈ ਖਬਰ ਦੇਖਣ ਨੂੰ ਜਾਂ ਸੁਣਨ ਨੂੰ ਮਿਲ ਜਾਂਦੀ ਹੈਗੀ ਆ ਇਸ ਬਾਰੇ